ਭੰਗੜਾ ਪੰਜਾਬੀਆਂ ਦੀ ਸ਼ਾਨ ਨੇ ਜ਼ਿਆਦਾਤਰ ਇਹ ਪੰਜਾਬੀ ਲੋਕ ਕਰਦੇ ਨੇ ਪਰ ਅੱਜ ਕੱਲ੍ਹ ਇਹ ਹਰ ਥਾਂ ਕੀਤਾ ਜਾਂਦਾ ਨੇ ਵਿਦੇਸ਼ਾਂ ਵਿੱਚ ਵੀ ਅੱਜ ਕੱਲ੍ਹ ਬੜਾ ਫੇਮਸ ਹੋਇਆ ਨੇ ਪੰਜਾਬੀ ਲੋਕ ਇਸ ਨੂੰ ਹਰ ਵਿਆਹ ਸ਼ਾਦੀ ਦੇ ਮੌਕੇ 'ਤੇ ਜਾਂ ਤਿਉਹਾਰ ਦੇ ਮੌਕੇ 'ਤੇ ਕਰਦੇ ਨੇ ਪੰਜਾਬੀਆਂ ਲੋਕਾਂ ਦੇ ਵਿੱਚ ਇਹ ਬੜਾ ਫੇਮਸ ਨੇ ਪੰਜਾਬ ਦੇ ਵਿੱਚ ਭੰਗੜਾ ਜ਼ਿਆਦਾ ਪਾਇਆ ਕੀਤਾ ਜਾਂਦਾ ਨੇ ਭੰਗੜਾ ਕਰਨ ਨਾਲ ਆਪਣੇ ਹੱਥ ਪੈਰ ਹਿੱਲਦੇ ਹੈ ਆਪਣੇ ਹੱਥਾਂ ਪੈਰਾਂ ਦੇ ਹਿੱਲਣ ਨਾਲ ਆਪਣੇ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਆਪਣੇ ਸਾਰੇ ਸਰੀਰ ਦੇ ਮੂਮੈਂਟ ਹਿੱਲਦੇ ਨੇ ਹੁੰਦੇ ਨੇ ਅਤੇ ਭੰਗੜਾ ਐਰੋਪਿਕ ਇੱਕ ਤਰ੍ਹਾਂ ਦੀ ਮੋਡਰਨ ਕਸਰਤ ਹੈ ਜੋ ਕਿ ਜਿਮ ਦੇ ਵਿੱਚ ਜ਼ਿਆਦਾ ਹਾਈ ਬੀਟ 'ਤੇ ਗਾਣੇ ਲਾ ਕੇ ਕੀਤੀ ਜਾਂਦੀ ਹੈ ਅੱਜ ਕੱਲ੍ਹ ਵੈਸੇ ਲੋਕ ਵੀ ਆਪਣੇ ਘਰਾਂ ਦੇ ਵਿੱਚ ਹਾਈ ਬੀਟ 'ਤੇ ਗਾਣੇ ਲਾ ਕੇ ਕਰਦੇ ਨੇ ਇਸ ਤਰ੍ਹਾਂ ਹੱਥਾਂ ਪੈਰਾਂ ਦੀ ਕਸਰਤ ਹੋ ਜਾਂਦੀ ਹੈ ਅਤੇ ਪੰਜਾਬੀ ਸੰਗੀਤ ਅਤੇ ਡਾਂਸ ਦੀ ਵਰਤੋਂ ਵਿੱਚ ਕਰਦੇ ਨੇ ਕਸਰਤ ਕਰਦੇ ਕਸਰਤ ਦੇ ਵਿੱਚ ਇਸ ਨੂੰ ਕਰਦੇ ਨੇ ਅਤੇ ਲੋਕ ਇਸ ਨੂੰ ਬੜੀ ਖੁਸ਼ੀ ਨਾਲ ਕਰਦੇ ਨੇ ਅਤੇ ਇਹ ਹਾਈ ਬੀਟ 'ਤੇ ਗਾਣੇ ਲਾ ਕੇ ਬੜੇ ਸ਼ੌਕ ਨਾਲ ਲੋਕ ਕਰਦੇ ਨੇ ਹੱਥਾਂ ਪੈਰਾਂ ਦੇ ਹਿੱਲਣ ਨਾਲ ਆਪਣਾ ਸਰੀਰ ਤੰਦਰੁਸਤ ਰਹਿੰਦਾ ਹੈ ਜੋ ਕਿ ਸਾਰਾ ਦਿਨ ਆਪਾਂ ਨੂੰ ਤੰਦਰੁਸਤੀ ਬਣੀ ਰਹਿੰਦੀ ਹੈ ਤੰਦਰੁਸਤ ਰਹਿਣ ਤੰਦਰੁਸਤੀ ਬਣੀ ਰਹਿਣ ਨਾਲ ਆਪਣਾ ਸਰੀਰ ਵੀ ਬੜਾ ਐਕਟਿਵ ਰਹਿੰਦਾ ਨੇ ਅਤੇ ਜ਼ਿਆਦਾਤਰ ਲੋਕ ਹੁਣ ਇਸ ਦੇ ਵਿੱਚ ਇੰਟਰਸਟ ਰੱਖਣ ਲੱਗੇ ਨੇ